ਚਿੱਤਰਕਾਰੀ ਦੀ ਕਲਾਸ ਮੈਂ ਬਹੁਤ ਵਾਰ ਲਗਵਾਈ ਹੈ ਇਸ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਜਿਵੇਂ ਕਿ ਚਿੱਤਰਕਾਰੀ ਨੂੰ ਕਿਸ ਤਰੀਕੇ ਨਾਲ ਕਰਨਾ ਹੈ ਕਿਸ ਚਿੱਤਰਕਾਰੀ ਲਈ ਕਿਸ ਤਰ੍ਹਾਂ ਦੇ ਸਮਾਨ ਦੀ ਜ਼ਰੂਰਤ ਹੁੰਦੀ ਹੈ ਅਤੇ ਇਸ ਤੋਂ ਮੈਂ ਇਹ ਵੀ ਸਿੱਖਿਆ ਹੈ ਕਿ ਕਿਸ ਤਰ੍ਹਾਂ ਦੀ ਚਿੱਤਰਕਾਰੀ ਨੂੰ ਕਿੰਨਾ ਟਾਈਮ ਦੇਣਾ ਹੈ ਅਤੇ ਉਸ ਚਿੱਤਰਕਾਰੀ ਨੂੰ ਕਿਸ ਅਨੁਭਵ ਨਾਲ ਪੂਰਾ ਕਰਨਾ ਹੈ ਇਸ ਤੋਂ ਇਲਾਵਾ ਮੈਂ ਚਿੱਤਰਕਾਰੀ ਨੂੰ ਬਹੁਤ ਹੀ ਇੱਕ ਪਰਾਊਡ ਫੀਲ ਕਰਨ ਵਾਲੀ ਏ ਹੈਬਿਟ ਕਹਿ ਸਕਦੀ ਹਾਂ ਜਿਵੇਂ ਕਿ ਇਸ ਚਿੱਤਰਕਾਰੀ ਨਾਲ ਇੱਕ ਆਦਮੀ ਛੋਟੇ ਲੈਵਲ ਤੋਂ ਬਹੁਤ ਉੱਪਰ ਵੱਲ ਜਾ ਸਕਦਾ ਹੈ ਅਤੇ ਬਹੁਤ ਵੱਡਾ ਮੁਕਾਮ ਹਾਸਲ ਕਰ ਸਕਦਾ ਹੈ ਇਸ ਤੋਂ ਇਲਾਵਾ ਚਿੱਤਰਕਾਰੀ ਵਿੱਚ ਅਸੀਂ ਤਰ੍ਹਾਂ ਤਰ੍ਹਾਂ ਦੇ ਚਿੱਤਰ ਦਿਖਾ ਸਕਦੇ ਹਾਂ ਮਨੁੱਖ ਨਾਲ ਜੁੜੀਆਂ ਪਸ਼ੂ ਪੰਛੀਆਂ ਨਾਲ ਜੁੜੀਆਂ ਅਤੇ ਵਾਤਾਵਰਨ ਅਤੇ ਹੋਰ ਕਈ ਕੁਦਰਤੀ ਚੀਜ਼ਾਂ ਨੂੰ ਦਰਸਾ ਸਕਦੇ ਹਾਂ ਮਨੁੱਖ ਦੇ ਮਨੋਭਾਵ ਆਦਿ ਨੂੰ ਦਰਸਾ ਸਕਦੇ ਹਾਂ